ਮੈਂ ਖਬਰਾਂ ਪੜ੍ਹਨ ਦਾ ਬਹੁਤ ਸ਼ੌਕੀਨ ਹਾਂ ਅਤੇ ਮੈਨੂੰ ਹਰ ਤਰ੍ਹਾਂ ਦੀਆਂ ਖਬਰਾਂ ਜਿਵੇਂ ਰਾਜਨੀਤੀ ਫ਼ਿਲਮਾਂ ਸਿਹਤ ਦੀਆਂ ਖਬਰਾਂ ਆਵਾਜਾਈ ਸੜਕਾਂ ਖੇਡਾਂ ਨਾਲ ਸੰਬੰਧਿਤ ਖਬਰਾਂ ਬਹੁਤ ਪਸੰਦ ਹਨ ਮੈਂ ਪਹੇਲੀਆਂ ਵੀ ਦੇਖਦਾ ਹਾਂ ਅਤੇ ਉਹਨਾਂ ਨੂੰ ਬੁੱਝਣ ਦੀ ਕੋਸ਼ਿਸ਼ ਕਰਦਾ ਹਾਂ ਅਤੇ ਮਜ਼ੇਦਾਰ ਕੋਮਿਕਸ ਵੀ ਬਹੁਤ ਪਸੰਦ ਹਨ ਮੇਰਾ ਬਹੁਤ ਵਧੀਆ ਟਾਈਮ ਨਿਕਲ ਜਾਂਦਾ ਹੈ ਮੈਂ ਰੋਜ਼ਾਨਾ ਪੇਪਰ ਪੜ੍ਹਦਾ ਹਾਂ ਸਾਡੇ ਘਰ ਸਵੇਰੇ ਸੱਤ ਵਜੇ ਪੇਪਰ ਆ ਜਾਂਦਾ ਹੈ ਮੈਂ ਚਾਹ ਦੇ ਨਾਲ ਨਾਲ ਅਖਬਾਰ ਪੜ੍ਹਦਾ ਹਾਂ ਅਤੇ ਫਿਰ ਖਾਣਾ ਖਾਣ ਤੋਂ ਬਾਅਦ ਵੀ ਕੁਝ ਸਮਾਂ ਅਖਬਾਰ ਪੜ੍ਹ ਕੇ ਹੀ ਕੰਮ 'ਤੇ ਜਾਂਦਾ ਹਾਂ ਅਤੇ ਮੈਨੂੰ ਪੇਪਰ ਪੜ੍ਹਨਾ ਬਹੁਤ ਪਸੰਦ ਹੈ